ਮੇਰੇ ਦੁਆਰਾ ਪੜ੍ਹੀ ਗਈ ਜਿਹੜੀ ਆਖਰੀ ਕਿਤਾਬ ਸੀਗੀ ਉਹ ਸੀਗੀ ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਹੋਈ ਅੱਜ ਆਖਾਂ ਵਾਰਿਸ ਸ਼ਾਹ ਨੂੰ ਇਹਦੀਆਂ ਦੋ ਕੁ ਲਾਈਨਾਂ ਮੈਂ ਤੁਹਾਨੂੰ ਦੱਸਦੀ ਸੀ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਫਿਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਇਹਦੇ ਵਿੱਚ ਇੱਕ ਅੰਮ੍ਰਿਤਾ ਪ੍ਰੀਤਮ ਦੀ ਕੀ ਖਾਸੀਅਤ ਆ ਕਿ ਉਹਨੇ ਇਹਦੇ ਵਿਚ ਇਕ ਔਰਤ ਦੀ ਤ੍ਰਾਸਦੀ ਨੂੰ ਪੇਸ਼ ਕੀਤਾ ਗਿਆ ਏ ਕਿ ਜਦੋਂ ਬਟਵਾਰਾ ਹੋਇਆ ਸੀਗਾ ਭਾਰਤ ਅਤੇ ਪਾਕਿਸਤਾਨ ਦਾ ਕਿ ਉੱਥੇ ਉਸ ਸਮੇਂ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨਾਲ ਬਹੁਤ ਹੀ ਮਾੜਾ ਵਿਵਹਾਰ ਸੀ ਜਿਹੜਾ ਕੀਤਾ ਗਿਆ ਸੀਗਾ ਤਾਂ ਉਸ ਸਮੇਂ ਅੰਮ੍ਰਿਤਾ ਪ੍ਰੀਤਮ ਨੇ ਇਹ ਦੇਸ਼ ਦੀ ਵੰਡ ਸਮੇਂ ਲਿਖੀ ਸੀਗੀ ਅਤੇ ਇਹਦੇ ਵਿੱਚ ਜਿਹੜੀ ਇੱਕ ਔਰਤ ਹੈ ਉਹਦਾ ਜੋ ਉਹਦੇ ਨਾਲ ਹੋਇਆ ਸੀ ਮਾੜਾ ਉਹ ਘਟਨਾ ਨੂੰ ਬਿਆਨ ਕੀਤਾ ਹੋਇਆ ਏ